ਪੰਜਾਬ ਟੂਰ ਗਾਈਡ ਜੋ ਵੀ ਸਾਨੂੰ ਇੱਥੇ ਮਿਲ ਜਾਂਦੇ ਨੇ ਕਈ ਹੋਟਲ ਵਾਲਿਆਂ ਨੇ ਆਪਣੇ ਪਰਸਨਲ ਬੰਦੇ ਰੱਖੇ ਹੁੰਦੇ ਨੇ ਐਜ਼ ਆ ਗਾਈਡ ਜੋ ਤੁਹਾਨੂੰ ਦੋ ਤਿੰਨ ਦਿਨ ਲਈ ਪ੍ਰੈਫਰ ਕਰ ਦਿੱਤੇ ਜਾਂਦੇ ਨੇ ਅਗਰ ਅਸੀਂ ਹਰਿਮੰਦਰ ਸਾਹਿਬ ਦੀ ਗੱਲ ਕਰੀਏ ਉਹ ਸਾਨੂੰ ਉੱਥੋਂ ਦਾ ਇਤਿਹਾਸ ਜਲਿਆਂਵਾਲੇ ਬਾਗ ਦਾ ਇਤਿਹਾਸ ਬੜੇ ਹੀ ਸੋਹਣੇ ਤਰੀਕੇ ਡਿਟੇਲ ਦੇ ਨਾਲ ਦੱਸ ਦਿੰਦੇ ਨੇ ਇਹ ਗਾਈਡ ਸਾਨੂੰ ਪੰਜਾਬੀ ਹਿੰਦੀ ਇੰਗਲਿਸ਼ ਲੈਗੂਏਜ਼ ਦੇ ਵਿੱਚ ਸੋਹਣੇ ਤਰੀਕੇ ਗਾਈਡ ਕਰ ਦਿੰਦੇ ਆ ਅਗਰ ਕੋਈ ਵੀ ਬਾਹਰ ਦਾ ਬੰਦਾ ਆਉਂਦਾ ਜਿਸ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਇੰਗਲਿਸ਼ ਨਹੀਂ ਆਉਂਦੀ ਜਿਹੜੀ ਵੀ ਭਾਸ਼ਾ ਤੁਸੀਂ ਕਹੋ ਉਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸ ਦਿੰਦੇ ਨੇ ਜਿਹਦੇ ਨਾਲ ਆਏ ਹੋਏ ਬੰਦੇ ਨੂੰ ਪ੍ਰੋਬਲਮ ਨਹੀਂ ਹੁੰਦੀ ਇੱਥੋਂ ਦਾ ਇਤਿਹਾਸ ਜਾਣਨ ਵਾਸਤੇ ਜੋ ਕਿ ਵਧੀਆ ਫੈਸੇਲਿਟੀ ਆ ਜੋ ਹੋਟਲ ਦੇ ਗਾਈਡ ਰਹਿੰਦੇ ਨੇ ਉਹ ਵੀ ਆਪਣਾ ਪੂਰਾ ਬੈਸਟ ਦਿੰਦੇ ਨੇ ਅਤੇ ਜੋ ਅਗਰ ਅਸੀਂ ਪਰਸਨਲ ਗਾਈਡ ਦੀ ਵੀ ਗੱਲ ਕਰੀਏ ਤਾਂ ਉਹ ਵੀ ਸੇਮ ਤਰੀਕੇ ਦੇ ਨਾਲ ਕੰਮ ਕਰਦੇ ਨੇ ਧੰਨਵਾਦ